ਪੰਜਾਬੀ ਪੰਜਾਬੀ ਬੋਲੀ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਹੈ ਜੇਕਰ ਕੋਈ ਵੀ ਇਨਸਾਨ ਕਿਤੇ ਵੀ ਪੰਜਾਬ ਤੋਂ ਬਾਹਰ ਜਾਂਦਾ ਹੈ ਤਾਂ ਉਸ ਦੀ ਬੋਲੀ ਤੋਂ ਹੀ ਪੰਜਾਬੀ ਹੋਣ ਦਾ ਪਤਾ ਲੱਗਦਾ ਹੈ ਮੇਰੀ ਪੋਸ਼ਾਕ ਬੋਲੀ ਅਤੇ ਖਾਣ ਪੀਣ ਦੇ ਢੰਗ ਤੋਂ ਪਤਾ ਲੱਗਦਾ ਹੈ ਕਿ ਮੈਂ ਪੰਜਾਬੀ ਹਾਂ ਪੰਜਾਬੀ ਬੋਲੀ ਕੱਪੜੇ ਅਤੇ ਉਹਨਾਂ ਦੇ ਸੁਭਾਅ ਤੋਂ ਅਤੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਮੈਂ ਪੰਜਾਬੀ ਹਾਂ ਪੰਜਾਬੀ ਪੰਜਾਬ ਦੀ ਮੁੱਖ ਭਾਸ਼ਾ ਹੈ ਇਹ ਭਾਸ਼ਾ ਬੋਲਣ ਵਿੱਚ ਬਹੁਤ ਚੰਗੀ ਲੱਗਦੀ ਹੈ ਅਤੇ ਇਹ ਭਾਸ਼ਾ ਸੁਣਨ ਵਿੱਚ ਬਹੁਤ ਸੁੰਦਰ ਹੈ ਇਸ ਭਾਸ਼ਾ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਕਿ ਇਸ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਗੁਰਮੁਖੀ ਵੀ ਕਿਹਾ ਜਾਂਦਾ ਹੈ ਇਹ ਭਾਸ਼ਾ ਕਈ ਰਾਜਾਂ 'ਚ ਸਮਝ ਵੀ ਲੈਂਦੇ ਹਨ ਅਤੇ ਕਈ ਭਾਸ਼ਾ ਇਹ ਲੋਕ ਕਈ ਲੋਕ ਇਹ ਭਾਸ਼ਾ ਨੂੰ ਬੋਲ ਵੀ ਲੈਂਦੇ ਹਨ